ਮੈਂ ਨਾ ਇੱਕ ਐਨ ਜੀ ਓ ਸੰਸਥਾ ਨਾਲ ਜੁੜੀ ਹੋਈ ਹਾਂ ਮੈਨੂੰ ਆਪਣੇ ਆਲੇ ਦੁਆਲੇ ਦੇ ਇਲਾਕਿਆਂ ਨਾਲ ਜਿਵੇਂ ਬਹੁਤ ਜ਼ਿਆਦਾ ਪਿਆਰ ਹੈਗਾ ਹੈ ਸਾਫ਼ ਸਫ਼ਾਈ ਨਾਲ ਬਹੁਤ ਜ਼ਿਆਦਾ ਪਿਆਰ ਹੈਗਾ ਹੈ ਜਿੱਥੇ ਕੂੜਾ ਕਰਕਟ ਹੋਵੇ ਨਾਲ ਹੀ ਆਪਾਂ ਦੀ ਇੱਕ ਟੀਮ ਹੈਗੀ ਹੈ ਉਹ ਨਾਲ ਹੀ ਉੱਥੇ ਸਾਫ਼ ਸਫ਼ਾਈ ਕਰ ਦਿੰਦੀ ਹੈ ਕੋਈ ਬਾਰਿਸ਼ ਦਾ ਮਾਹੌਲ ਹੋਵੇ ਕਿਤੇ ਵੀ ਨਾਲੀਆਂ 'ਚ ਪਾਣੀ ਪੂਣੀ ਭਰਿਆ ਹੋਵੇ ਸਾਈਡ 'ਤੇ ਇੱਟਾਂ ਉੱਟਾਂ ਕਰਕੇ ਸ ਪੂਰੀ ਸਾਫ਼ ਸਫ਼ਾਈ ਕਰ ਦਿੰਦੀ ਆ ਜਿਵੇਂ ਰੁੱਖ ਵਗੈਰਾ ਲਗਾਉਣ ਦਾ ਵੀ ਮੈਨੂੰ ਬਹੁਤ ਜ਼ਿਆਦਾ ਸ਼ੌਕ ਹੈ ਰੁੱਖਾਂ ਨੂੰ ਪਾਣੀ ਦੇਣਾ ਪੇੜ ਪੌਦਿਆਂ ਨੂੰ ਦੀ ਸਫ਼ਾਈ ਰੱਖਣਾ ਉਹਨਾਂ ਦੇ ਜਿਹੜੇ ਪੱਤੇ ਵਗੈਰਾ ਹੁੰਦੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਜਿਵੇਂ ਬਹੁਤ ਜ਼ਿਆਦਾ ਸ਼ੌਕ ਰੱਖਿਆ ਹੋਇਆ ਹੈ ਇਹੋ ਜਿਹਾ ਸਾਡੀ ਟੀਮ ਵੀ ਬੜੇ ਪਿਆਰ ਨਾਲ ਜਿਵੇਂ ਕੋਈ ਗਰੀਬ ਲੋਕ ਹੁੰਦੇ ਆ ਸੜਕਾਂ ਵਿੱਚ ਪਏ ਹੁੰਦੇ ਹਨ ਉਨ੍ਹਾਂ ਦੀ ਵੀ ਬਹੁਤ ਜ਼ਿਆਦਾ ਰੱਖਿਆ ਕਰਦੀ ਹੈ ਜੇ ਕੋਈ ਠੰਡ ਦਾ ਮੌਸਮ ਹੁੰਦਾ ਉਹਨਾਂ ਨੂੰ ਕੰਬਲ ਵਗੈਰਾ ਬਹੁਤ ਜ਼ਿਆਦਾ ਉਹਨਾਂ ਦੀ ਸਹਾਇਤਾ ਕਰਦੀ ਹੈ ਹੋਰ ਵੀ ਇਲਾਕਿਆਂ ਦੀ ਸਾਫ਼ ਸਫ਼ਾਈ ਕਰਨ ਲਈ ਜੇ ਕਿਤੇ ਸਾਈਡਾਂ 'ਤੇ ਕੂੜਾ ਕਰਕਟ ਵਗੈਰਾ ਡਿੱਗਾ ਹੁੰਦਾ ਵਾ ਡਸਟਬੀਨ ਵਗੈਰਾ ਨਹੀਂ ਲੱਗੇ ਹੁੰਦੇ ਅਤੇ ਉਹਨਾਂ ਨੂੰ ਚੁੱਕ ਕੇ ਕਿਤੇ ਇੱਕ ਜਗ੍ਹਾ 'ਤੇ ਸਟੋਰ ਕਰਕੇ ਰੱਖ ਦਿੰਦੇ ਹਾਂ ਬਾਅਦ ਵਿੱਚ ਉਹਨਾਂ ਨੂੰ ਅੱਗ ਵਗੈਰਾ ਬਾਲ ਦਿੰਦੇ ਹੈ ਕਿ ਸੜ ਜਾਵੇ ਅਤੇ ਇਸੇ ਤਰ੍ਹਾਂ ਸਾਨੂੰ ਆਪਣੇ ਇਲਾਕਿਆਂ ਦੀ ਸਾਫ਼ ਸਫ਼ਾਈ ਦਾ ਪੂਰਾ ਧਿਆਨ ਵੀ ਰੱਖਣਾ ਚਾਹੀਦਾ ਹੈ ਜੇ ਕਿਤੇ ਕੂੜਾ ਕਰਕਟ ਡਿੱਗਾ ਹੋਵੇ ਸਾਨੂੰ ਥਾਂ ਥਾਂ 'ਤੇ ਡਸਟਬੀਨ ਲਗਾਉਣੇ ਚਾਹੀਦੇ ਹਨ ਕਿ ਉਹ ਸਾਰਾ ਕੂੜਾ ਕਰਕਟ ਡਸਟਬੀਨ ਵਿੱਚ ਹੀ ਸੁੱਟਣਾ ਚਾਹੀਦਾ ਹੈ ਬਾਹਰ ਦੇ ਸ਼ਹਿਰਾਂ 'ਚ ਵੇਖਿਆ ਹੋਇਆ ਕਿ ਥਾਂ ਥਾਂ 'ਤੇ ਡਸਟਬੀਨ ਲੱਗੇ ਹੋਏ ਆ ਲੋਕ ਬਹੁਤ ਸਾਫ਼ ਸਫ਼ਾਈ ਦਾ ਬਹੁਤ ਜ਼ਿਆਦਾ ਧਿਆਨ ਰੱਖਦੇ ਹਨ ਇਸੇ ਤਰ੍ਹਾਂ ਸਾਨੂੰ ਵੀ ਚਾਹੀਦਾ ਕਿ ਆਪਾਂ ਵੀ ਆਪਣੇ ਪੰਜਾਬ ਵਿੱਚ ਸਾਫ਼ ਸਫ਼ਾਈ ਦੀ ਪੂਰੀ ਤਰ੍ਹਾਂ ਧਿਆਨ ਰੱਖੀਏ ਜਿੱਥੇ ਵੀ ਗੰਦ ਵਗੈਰਾ ਖਿਲਾਰਾ ਵਗੈਰਾ ਪਿਆ ਹੋਵੇ ਸਭ ਤੋਂ ਪਹਿਲਾਂ ਤਾਂ ਸਾਫ਼ ਸਫ਼ਾਈ ਦਾ ਆਪਣੇ ਘਰ ਤੋਂ ਹੀ ਧਿਆਨ ਰੱਖਣਾ ਚਾਹੀਦਾ ਹੈ ਕਿ ਘਰ 'ਚ ਵੀ ਆਪਾਂ ਜਿਵੇਂ ਆਪਾਂ ਆਪਣੇ ਘਰ ਦੀ ਪੂਰੀ ਸਾਫ਼ ਸਫ਼ਾਈ ਕਰਦੇ ਹਾਂ ਉਦਾਂ ਹੀ ਆਪਣੇ ਬਾਹਰ ਦੇ ਇਲਾਕਿਆਂ ਦੀ ਵੀ ਸਾਫ਼ ਸਫ਼ਾਈ ਕਰਾਂਗੇ ਘਰ ਵੀ ਆਪਾਂ ਕੋਈ ਚੀਜ਼ ਵਗੈਰਾ ਸੁੱਟਦੇ ਨਹੀਂ ਅਤੇ ਜੇ ਸੁੱਟੀਏ ਤਾਂ ਆਪਾਂ ਇੱਕ ਡਸਟਬੀਨ ਵਿੱਚ ਸੁੱਟਦੇ ਹਾਂ ਆਪਣੇ ਬੱਚਿਆਂ ਨੂੰ ਵੀ ਇਹ ਚੀਜ਼ ਸਿਖਾਉਂਦੇ ਹਾਂ ਕਿ ਨਹੀਂ ਬੱਚਾ ਕਿ ਤੁਸੀਂ ਐਦਾਂ ਆਪਣੇ ਘਰ 'ਚ ਖਿਲਾਰਾ ਨਹੀਂ ਪਾਉਣਾ ਡਸਟਬੀਨ ਵਿੱਚ ਸੁੱਟਣੀ ਹੈ ਇਸੇ ਤਰ੍ਹਾਂ ਸਾਨੂੰ ਇਹ ਵੀ ਚਾਹੀਦਾ ਕੀ ਆਪਣੇ ਇਲਾਕਿਆਂ ਵਿੱਚ ਸਾਨੂੰ ਸੜਕਾਂ ਵਿੱਚ ਕੋਈ ਵੀ ਚੀਜ਼ ਵਗੈਰਾ ਖਾ ਕੇ ਉੱਥੇ ਨਹੀਂ ਸੁੱਟਣੀ ਚਾਹੀਦੀ ਬਾਜ਼ਾਰਾਂ ਵਿੱਚ ਜਾਂ ਸੜਕਾਂ 'ਚ ਨਹੀਂ ਸੁੱਟਣੀ ਚਾਹੀਦੀ ਸਾਨੂੰ ਡਸਟਬੀਨ ਵਿੱਚ ਸੁੱਟਣੀ ਚਾਹੀਦੀ ਐ ਜਾਂ ਵੱਡੇ ਵੱਡੇ ਹੋਰ ਵੀ ਕੂੜਾਦਾਨ ਵਗੈਰਾ ਫੈਕਟਰੀਆਂ ਹੁੰਦੀਆਂ ਉਹਨਾਂ ਵਿੱਚ ਜਾ ਕੇ ਸਟੋਰ ਕਰਕੇ ਸੁੱਟ ਦੇਣਾ ਚਾਹੀਦਾ ਹੈ ਹੋਰ ਵੀ ਸਾਡੀ ਕਾਫੀ ਜਗ੍ਹਾ 'ਤੇ ਟੀਮ ਫੈਲੀ ਹੋਈ ਹੈ ਜੋ ਕਿ ਸਾਫ਼ ਸਫ਼ਾਈ ਲਈ ਬਹੁਤ ਜ਼ਿਆਦਾ ਮਦਦ ਕਰਦੀ ਹੈ ਪੇੜ ਪੌਂਦਿਆਂ ਦੀ ਵੀ ਸਾਂਭ ਸੰਭਾਲ ਕਰਦੀ ਹੈ ਪੇੜ ਪੌਂਦਿਆਂ ਨੂੰ ਪਾਣੀ ਦਿੰਦੀ ਹੈ ਮੈਂ ਖੁਦ ਆਪਣੇ ਘਰ ਦੇ ਆਲੇ ਦੁਆਲੇ ਕਾਫੀ ਸਾਰੇ ਪੇੜ ਪੌਦੇ ਲਗਾਏ ਹੋਏ ਹਨ ਉਹਨਾਂ ਨੂੰ ਪਾਣੀ ਦਿੰਦੇ ਹਾਂ ਉਹਨਾਂ ਦੀ ਰੱਖਿਆ ਸਾਂਭ ਸੰਭਾਲ ਕਰਦੇ ਹਾਂ ਕਿਉਂਕਿ ਇਹ ਵੀ ਤਾਂ ਇੱਕ ਕੁਦਰਤ ਦਾ ਨਿਯਮ ਹੈ ਕਿ ਜੇ ਆਪਾਂ ਪੇੜ ਪੌਦਿਆਂ ਦੀ ਸਾਂਭ ਸੰਭਾਲ ਕਰਾਂਗੇ ਇਹਨਾਂ ਨੂੰ ਪਿਆਰ ਕਰਾਂਗੇ ਤਾਂ ਇਹ ਵੱਧਣਗੇ ਫੁੱਲਣਗੇ ਸਾਨੂੰ ਜਿਵੇਂ ਕੀ ਪ੍ਰਫੁੱਲਿਤ ਇੱਕ ਸ਼ੁੱਧ ਹਵਾ ਦੇਣਗੇ ਜੋ ਕਿ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਨੂੰ ਬਿਮਾਰੀਆਂ ਤੋਂ ਬਚਾਉਣਗੇ ਵੈਸੇ ਵੀ ਸਾਨੂੰ ਪੇੜ ਪੌਦੇ ਲਗਾਉਣੇ ਚਾਹੀਦੇ ਹਨ ਸਾਫ਼ ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਇਹੀ ਤਾਂ ਸਾਡਾ ਜੀਵਨ ਹੈ ਇਹੀ ਤਾਂ ਸਾਡੀ ਜ਼ਿੰਦਗੀ ਹੈ ਕੀ ਆਪਣੇ ਵਾਤਾਵਰਨ ਨੂੰ ਸੋਹਣਾ ਬਣਾ ਸਕੀਏ ਕਿ ਜਿੱਥੇ ਰਹੀਏ ਐਂ ਸੋਹਣੇ ਖੁਸ਼ਹਾਲ ਨਾਲ ਰਹੀਏ ਜਿੱਥੇ ਵੀ ਰਹੀਏ ਆਪਾਂ